ਵੀ ਪੀ ਐੱਨ ਦਾ ਪੂਰਾ ਨਾਂ ਵਰਚੁਅਲ ਪ੍ਰਾਈਵੇਟ ਨੈਟਵਰਕ ਹੈ ਇਹ ਇੰਟਰਨੈਟ 'ਤੇ ਵਰਤੀ ਜਾਂਦੀ ਸੇਵਾ ਹੈ ਜੋ ਕਿ ਤੁਹਾਡਾ ਡਾਟਾ ਲੀਕ ਹੋਣ ਤੋਂ ਬਚਾਉਂਦੀ ਹੈ ਅਤੇ ਇਹ ਸਾਨੂੰ ਓਨਲਾਈਨ ਗੋਪਨੀਯਤਾ ਪ੍ਰਦਾਨ ਕਰਦੀ ਹੈ ਵੀ ਪੀ ਐੱਨ ਜਿਹੜੀ ਹੈ ਇਹ ਸਾਨੂੰ ਆਈ ਪੀ ਪਤਾ ਜਿਹੜਾ ਹੁੰਦਾ ਸਾਡਾ ਉਹਨੂੰ ਲੁਕਉਂਦੀ ਹੈ ਅਤੇ ਓ ਅਤੇ ਸਾਡੀ ਓਨਲਾਈਨ ਜਾਣਕਾਰੀ ਹੈ ਜਿਹੜੀ ਉਹਨੂੰ ਨਿੱਜੀ ਰੱਖਣ ਵਿੱਚ ਇਜਾਜ਼ਤ ਦਿੰਦੀ ਹੈ ਜਦੋਂ ਵੀ ਪੀ ਐੱਨ ਸਾਡੇ ਕਿਸੇ ਫੋਨ ਵਿੱਚ ਲੈਪਟੋਪ ਵਿੱਚ ਨਾਲ ਜੁੜਦਾ ਹੈ ਤਾਂ ਇਹ ਸਾਨੂੰ ਇੰਟਰਨੈਟ ਕਿਸੇ ਹੋਰ ਕੰਪਿਊਟਰ ਨਾਲ ਜੋੜਦਾ ਹੈ ਜਿਸ ਨਾਲ ਅਸੀਂ ਉਸ ਕੰਪਿਊਟਰ 'ਤੇ ਇੰਟਰਨੈਟ ਦੀ ਵਰਤੋਂ ਕਰ ਸਕਦੇ ਹਾਂ ਜੇਕਰ ਉਹ ਦੂਜਾ ਕੰਪਿਊਟਰ ਹੈ ਜਿਸਨੂੰ ਸਰਵਰ ਵੀ ਕਿਹਾ ਜਾਂਦਾ ਹੈ ਕਿਸੇ ਹੋਰ ਦੇਸ਼ ਵਿੱਚ ਹੈ ਜਾਂ ਅਜਿਹਾ ਲੱਗਦਾ ਉੱਥੇ ਆਵਾਜਾਈ ਉੱਥੇ ਆ ਰਹੀ ਹੈ ਇਸ ਦੀ ਵਰਤੋਂ ਕਿਸੇ ਖਾਸ ਖੇਤਰ ਵਿੱਚ ਬਲੋਕ ਕੀਤੀਆਂ ਜਿਹੜੀਆਂ ਆਪਣੀਆਂ ਸਾਈਟਾਂ ਹੁੰਦੀਆਂ ਉਹਨਾਂ ਦੀ ਵਰਤੋਂ ਕਰਨ ਲਈ ਕੀਤੀ ਜਾਂਦੀ ਹੈ ਇਹ ਲੈਪਟੋਪ ਨਾਲ ਵੀ ਵੀ ਪੀ ਐੱਨ ਨੂੰ ਜੋੜਿਆ ਜਾਂਦਾ ਹੈ ਅਤੇ ਟਰੈਫਿਕ ਵੈਬਸਾਈਟ ਜਿਹੜੀ ਵੈਬਸਾਈਟ ਬਲੋਕ ਹੁੰਦੀ ਹੈ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਅਤੇ ਇਸ ਤਰ੍ਹਾਂ ਉਸ ਵੈਬਸਾਈਟ ਤੱਕ ਸਾਡੀ ਪਹੁੰਚ ਕਰਨ ਵਿੱਚ ਮਦਦ ਕਰਦੀ ਹੈ ਧੰਨਵਾਦ